ਹੈਲੋ ਸਤਿ ਸ਼੍ਰੀ ਅਕਾਲ ਜੀ ਜਿਹੜਾ ਮੈਂ ਤੁਹਾਤੋਂ ਸੋਫਾ ਮੰਗਵਾਇਆ ਜੀ ਇਹ ਬਹੁਤ ਵਧੀਆ ਜਿੱਦਾਂ ਦਾ ਮੈਂ ਚਾਹੁੰਦਾ ਸੀ ਉੱਦਾਂ ਦਾ ਹੀ ਮਿਲਿਆ ਮੈਂ ਭੂਰੇ ਰੰਗ ਦਾ ਚਾਹੁੰਦਾ ਸੀ ਰੰਗ ਵੀ ਇਹਦਾ ਭੂਰਾ ਹੀ ਨਿਕਲਿਆ ਅਤੇ ਇਹ 'ਤੇ ਜਿਹੜੇ ਸਪਰਿੰਗ ਨੇ ਉਹ ਬਹੁਤ ਵਧੀਆ ਨੇ ਅਤੇ ਜਿਹੜਾ ਇਹ 'ਤੇ ਕੱਪੜਾ ਲੱਗਿਆ ਇਸ ਇੱਕ ਇਹ ਜਿਹਾ ਮਲ ਮਲ ਰੇਸ਼ਮੀ ਕੱਪੜਾ ਹੀ ਲੱਗਦਾ ਏ ਜ ਜਦੋਂ ਬਹਿੰਦੇ ਹਾਂ ਸੋਫੇ 'ਤੇ ਤਾਂ ਬੜਾ ਆਨੰਦ ਆਉਂਦਾ ਅਤੇ ਉਹ ਤੋਂ ਬਾਅਦ ਜੇ ਇਹਦੀ ਲੱਕੜ ਦੇਖੀਏ ਲੱਕੜ ਮੈਂ ਤਾਂ ਟਾਹਲੀ ਦੀ ਭਾਲਦਾ ਸੀ ਅਤੇ ਅਜੇ ਤੱਕ ਤਾਂ ਟਾਹਲੀ ਉਹ ਲੱਗਦੀ ਹੈ ਬਹੁਤ ਸੋਹਣਾ ਇਹਦਾ ਕਲਰ ਹੈ ਟਾਹਲੀ ਲਾਲ ਰੰਗ ਦੀ ਹੁੰਦੀ ਹੈ ਮੈਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਉਹ ਤੋਂ ਬਾਅਦ ਤੁਸੀਂ ਜਿਹਦੇ ਥਰੂ ਭੇਜਿਆ ਡਿਲੀਵਰ ਕਰਨ ਆਇਆ ਤਾ ਉਹ ਵੀ ਤੁਹਾਡਾ ਜਿਹੜਾ ਬੰਦਾ ਸੀ ਮੈਨੂੰ ਬਹੁਤ ਅੱਛਾ ਲੱਗਿਆ ਅਤੇ ਉਹਨੇ ਮੇਰੇ ਤੋਂ ਕੋਈ ਫਾਲਤੂ ਪੈਸਾ ਨਹੀਂ ਮੰਗਿਆ ਅਤੇ ਨਾ ਉਹਨੇ ਕੋਈ ਗੱਲ ਕਰੀ ਹੈ ਅਤੇ ਉਹ ਤੋਂ ਬਾਅਦ ਜਿਹੜਾ ਇਹਦੀ ਪੈਕਿੰਗ ਤੀ ਪੈਕਿੰਗ ਬਹੁਤ ਬਹੁਤ ਹੀ ਵਧੀਆ ਪੈਕਿੰਗ ਤੀ ਮੈਂ ਜਿੱਦਾਂ ਦੀ ਭਾਲ਼ ਦਾ ਤੀ ਉੱਦਾਂ ਦੀ ਕੋਈ ਇੱਕ ਇਹਨੂੰ ਇੱਕ ਰਗੜਦਾ ਅਤੇ ਕੋਈ ਇੱਦਾਂ ਦਾ ਹੈ ਨਹੀਂ ਵੀ ਜਿਹਨੂੰ ਕਿਤੇ ਰਗੜ ਲੱਗੀ ਹੋਵੇ ਨਹੀਂ ਅੱਜ ਕੱਲ੍ਹ ਆਪਾਂ ਨੇ ਦੇਖਿਆ ਆਮ ਗੱਡੀਆਂ ਗੁੱਡੀਆਂ ਦੇ ਵਿੱਚ ਭਾਵੇਂ ਫਰਿੱਜ ਹੈ ਭਾਵੇਂ ਕੁਛ ਵੀ ਹੈ ਅਤੇ ਉਹਨੂੰ ਰਗੜਾਂ ਰੁਗੜਾਂ ਲੱਗ ਜਾਂਦੀਆਂ ਫਿਰ ਜਦੋਂ ਆਪਾਂ ਉਹਨਾਂ ਨੂੰ ਪੁੱਛਦੇ ਹਾਂ ਉਹ ਇਹ ਹੀ ਕਹਿੰਦੇ ਆ ਜੀ ਇਹ ਤਾਂ ਹੁੰਦਾ ਹੀ ਹੈ ਰੋਡ ਦੇ ਵਿੱਚ ਜਾਣੀ ਹੈ ਅਤੇ ਰਗੜ ਲੱਗੇਗੀ ਅਤੇ ਇਹ ਤੁਹਾਨੂੰ ਤੁਹਾਡਾ ਜਿਹੜੀ ਇਹ ਪ੍ਰੋਡਕਟ ਹੈ ਮੈਨੂੰ ਬਹੁਤ ਹੀ ਅੱਛਾ ਲੱਗਿਆ ਅੱਗੇ ਤੋਂ ਵੀ ਜੇ ਕੋਈ ਕਿਸੇ ਚੀਜ਼ ਦੀ ਜ਼ਰੂਰਤ ਹੋਵੇਗੀ ਤਾਂ ਤੁਹਾਡੇ ਨਾਲ਼ ਤਾਲਮੇਲ ਕਰਾਂਗੇ ਧੰਨਵਾਦ